ਜੇਕਰ ਪਸੰਦੀਦਾ ਭੋਜਨ ਵਿਅੰਜਨ ਚੈਨਲ ਦੀ ਗੱਲ ਕੀਤੀ ਜਾਵੇ ਤਾਂ ਯੂਟਿਊਬ 'ਤੇ ਤਾਂ ਮੈਂ ਅਕਸਰ ਸ਼ੋਰਟਸ ਜਾਂ ਛੋਟੀਆਂ ਮੋਟੀਆਂ ਵੀਡੀਓਜ਼ ਕੁਕਿੰਗ ਦੀਆਂ ਦੇਖਦੀ ਰਹਿੰਦੀ ਹਾਂ ਅਤੇ ਉਸ ਤੋਂ ਇਲਾਵਾ ਡਿਜਨੇ ਪਲੱਸ ਹੋਟਸਟਾਰ ਇੱਕ ਐਪ ਹੈ ਜਿਸਦੇ ਉੱਤੇ ਮਾਸਟਰ ਸ਼ੈੱਫ ਆਸਟ੍ਰੇਲੀਆ ਨਾਮ ਦਾ ਇੱਕ ਸ਼ੋਅ ਹੈ ਜੋ ਮੇਰਾ ਬਹੁਤ ਜ਼ਿਆਦਾ ਪਸੰਦੀਦਾ ਸ਼ੋਅ ਹੈ ਉਸ ਸ਼ੋਅ ਦੇ ਅੰਦਰ ਬਹੁਤ ਸਾਰੇ ਕੰਟੈਸਟੈਂਸ ਹੁੰਦੇ ਨੇ ਅਤੇ ਉਹ ਫਾਈਨਲ ਸਪੋਟ ਦੇ ਲਈ ਮਾਸਟਰ ਸ਼ੈੱਫ ਬਣਨ ਦੇ ਲਈ ਲੜਦੇ ਨੇ ਉਹ ਸ਼ੋਅ ਦੇ ਵਿੱਚੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੈ ਕਿਉਂਕਿ ਜਦ ਅਸੀਂ ਇੰਡੀਅਨ ਸ਼ੋਅਜ਼ ਦੇਖਦੇ ਹਾਂ ਤਾਂ ਆਪਾਂ ਨੂੰ ਸਿਰਫ਼ ਇੰਡੀਅਨ ਫੂਡ ਜਾਂ ਕਹਿ ਲਉ ਪੰਜਾਬੀ ਸ਼ੋਅਜ਼ ਦੇਖਦੇ ਹਾਂ ਤਾਂ ਪੰਜਾਬੀ ਫੂਡ ਬਾਰੇ ਹੀ ਪਤਾ ਲੱਗਦਾ ਪਰ ਉਹ ਸ਼ੋਅ ਜਿਹੜਾ ਹੈ ਉਹ ਆਸਟ੍ਰੇਲੀਆ ਦਾ ਜਿਹੜਾ ਮੈਂ ਅੱਜ ਕੱਲ੍ਹ ਦੇਖ ਰਹੀ ਹਾਂ ਉਸ ਦੇ ਅੰਦਰ ਸਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਕੁਜ਼ੀਨਸ ਦੇ ਬਾਰੇ ਪਤਾ ਲੱਗਦਾ ਜਿਵੇਂ ਕਿ ਮੈਕਸੀਕਨ ਕੁਜ਼ੀਨ ਇਟੈਲੀਅਨ ਕੁਜ਼ੀਨ ਸੀ ਫੂਡ ਦੇ ਬਾਰੇ ਪਤਾ ਲੱਗਦਾ ਮੈਨੂੰ ਬਹੁਤ ਸਾਰੇ ਨਵੇਂ ਨਵੇਂ ਜਿਹੜੇ ਸ਼ਬਦ ਨੇ ਉਹ ਸਿੱਖਣ ਨੂੰ ਮਿਲੇ ਨੇ ਉ ਉਹਨਾਂ ਸ਼ੋਅਜ਼ ਦੇ ਵਿੱਚੋਂ ਮੈਨੂੰ ਉਹਨਾਂ ਦੀਆਂ ਕੁਕਿੰਗ ਟੈਕਨੀਕਸ ਦੇ ਬਾਰੇ ਪਤਾ ਲੱਗਿਆ ਜਿਹੜੀਆਂ ਅਸੀਂ ਨਹੀਂ ਯੂਜ ਕਰਦੇ ਸਭ ਤੋਂ ਜ਼ਿਆਦਾ ਇੰਮਪਰੈਸਿਵ ਟੈਕਨੀਕ ਮੇਰੀ ਮੈਨੂੰ ਜਿਹੜੀ ਲੱਗੀ ਹੈ ਉਸ ਸ਼ੋਅ ਦੇ ਅੰਦਰ ਉਹ ਜਿਹੜੀ ਮੈਂ ਸਿੱਖੀ ਹੈ ਉਹ ਹੈ ਉਹਨਾਂ ਦਾ ਪਾਸਤਾ ਬਣਾਉਣਾ ਮਤਲਬ ਉਹ ਸਟਾਰਟਿੰਗ ਤੋਂ ਪਾਸਤਾ ਬਣਾਉਂਦੇ ਨੇ ਆਪ ਹੀ ਮੈਦੇ ਨਾਲ਼ ਗੁੰਨ ਕੇ ਅਸੀਂ ਅਕਸਰ ਤੌਰ 'ਤੇ ਜਿਹੜੇ ਪੰਜਾਬੀਜ਼ ਹੁੰਦੇ ਹਾਂ ਜਾਂ ਇੰਡੀਅਨ ਹੁੰਦੇ ਹਾਂ ਅਸੀਂ ਰੈਡੀਮੇਡ ਪਾਸਤਾ ਦੇ ਪੈਕਟ ਲਿਆ ਕੇ ਬੋਇਲ ਕਰਕੇ ਉਸਨੂੰ ਆਪਣੇ ਮਨਪਸੰਦੀਦਾਰ ਫਲੇਵਰਸ ਨਾਲ਼ ਬਣਾ ਲੈਂਦੇ ਹਾਂ ਪਰ ਜਿਹੜੇ ਇੰਟੈਲੀਅਨ ਲੋਕ ਨੇ ਮੈਂ ਦੇਖਿਆ ਉਹ ਪਾਸਤੇ ਦਾ ਡੋਅ ਵੀ ਖੁਦ ਤਿਆਰ ਕਰਦੇ ਆ ਫਿਰ ਉਹ ਡਿਫਰੈਂਟ ਡਿਫਰੈਂਟ ਸ਼ੇਪਸ ਦਾ ਪਾਸਤਾ ਬਣਾਉਂਦੇ ਨੇ ਅਤੇ ਫਿਰ ਉਹਨੂੰ ਬੋਇਲ ਕਰਦੇ ਨੇ ਅਤੇ ਮੈਨੂੰ ਇਹ ਬਹੁਤ ਜ਼ਿਆਦਾ ਇੰਟਰਸਟਿੰਗ ਲੱਗਿਆ ਉਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਡਿਜਰਟਸ ਹੁੰਦੇ ਨੇ ਆਈਸ ਕ੍ਰੀਮਸ ਹੁੰਦੀਆਂ ਨੇ ਉਹ ਉਹਨਾਂ ਨੂੰ ਕਈ ਵਾਰ ਲਿਕੁਇਡ ਨਾਈਟ੍ਰੋਜਨ ਦੇ ਨਾਲ਼ ਵੀ ਬਣਾਉਂਦੇ ਨੇ ਉਸ ਸ਼ੋਅ ਦੇ ਅੰਦਰ ਤਾਂ ਮੈਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਲੱਗਦਾ ਉਹ ਸ਼ੋਅ ਅਤੇ ਬਿਲਕੁਲ ਮੈਂ ਬਹੁਤ ਕੁਝ ਸਿੱਖਿਆ ਉਸ ਸ਼ੋਅ ਦੇ ਵਿੱਚ ਉਹ ਸਿਰਫ਼ ਵਰਡਸ ਹੀ ਨਹੀਂ ਮੈਂ ਬਹੁਤ ਸਾਰੀਆਂ ਰੈਸਿਪੀਸ ਵੀ ਦੇਖੀਆਂ ਅਤੇ ਬਹੁਤ ਸਾਰੀਆਂ ਕੁਕਿੰਗ ਟੈਕਨੀਕਸ ਵੀ ਸਿੱਖੀਆਂ